ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਹਾਂਜੀ ਮੇਰੀ ਗੱਲ ਦਾਵਤ ਵਾਲਿਆ ਨਾਲ ਹੋ ਰਹੀ ਆ ਹਾਂਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਮੈਂ ਨਾ ਤੁਹਾਡੇ ਕੋਲ ਨਾ ਹੁਣੇ ਓਡਰ ਲਿਖਵਾਇਆ ਸੀ ਇੱਕ ਹਾਂਜੀ ਗੁਰਪ੍ਰੀਤ ਕੌਰ ਤੇ ਨਾਮ 'ਤੇ ਹਾਂਜੀ ਭਾਜੀ ਮੇਰਾ ਔਡਰ ਸੀ ਸ਼ਾਹੀ ਪਨੀਰ ਪਾਲਕ ਪਨੀਰ ਦਾਲ ਚੌਲ ਅਤੇ ਨਾਨ ਹਾਂਜੀ ਭਾਅ ਜੀ ਮੈਨੂੰ ਨਾ ਹੁਣੇ ਔਡਰ ਆਇਆ ਤੁਹਾਡਾ ਮੈਂ ਲਿਖਵਾਇਆ ਸੀ ਅੱਧਾ ਘੰਟਾ ਪਹਿਲਾਂ ਹੁਣੇ ਹੁਣੇ ਮੈਨੂੰ ਭਾਈ ਦੇ ਕੇ ਗਿਆ ਹੈ ਲੇਕਿਨ ਮੇਰੇ ਘਰ ਦੇ ਪਹਿਲਾਂ ਹੀ ਪ੍ਰਾਹੁਣੇ ਆਏ ਹੋਏ ਸੀ ਅਤੇ ਪ੍ਰਾਹੁਣਿਆ ਕਰਕੇ ਮੰਗਾਇਆ ਸੀ ਹਾਂਜੀ ਅਤੇ ਤੁਹਾਡਾ ਭਾਜੀ ਦਾਲ ਅਤੇ ਦਾਲ ਚੋਂ ਬਹੁਤ ਜ਼ਿਆਦਾ ਬੋ ਆਉਂਦੀ ਪਈ ਹੈ ਅਤੇ ਪਾਲਕ ਪਨੀਰ ਅਤੇ ਪਾਲਕ ਪਨੀਰ ਦਾ ਵੀ ਬਹੁਤ ਜ਼ਿਆਦਾ ਬੋ ਆ ਰਹੀ ਹੈ ਹਾਂਜੀ ਭਾਅ ਜੀ ਜਿਹੜੇ ਮੈਂ ਫੁਲਕੇ ਮੰਗਵਾਏ ਸੀ ਮੈਂ ਤਾਂ ਨਾਨ ਆਡਰ ਕਰਵਾਏ ਸੀ ਲੇਕਿਨ ਤੁਸੀਂ ਮੈਨੂੰ ਫਿਰ ਵੀ ਸੁੱਕੇ ਫੁੱਲਕੇ ਭੇਜਤੇ ਹਾਂਜੀ ਭਾਅ ਜੀ ਹਾਂਜੀ ਅਤੇ ਭਾਅ ਜੀ ਅਸੀਂ ਤੁਹਾਨੂੰ ਝੂਠ ਥੋੜ੍ਹੀ ਨਾ ਕਹਾਂਗੇ ਸਾਡੇ ਕੋਲ ਜੋ ਤੁਹਾਡਾ ਸਮਾਨ ਆਇਆ ਵਾ ਭਾਵੇਂ ਤੁਸੀਂ ਸਾਡੇ ਕੋਲ ਆ ਕੇ ਆਪਣਾ ਸਮਾਨ ਚੈੱਕ ਕਰ ਲਓ ਨਹੀਂ ਨਹੀਂ ਭਾਅ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੁਹਾਡਾ ਸਮਾਨ ਦੇਖੋ ਕਿਵੇਂ ਹਜੇ ਮੈਂ ਲਿਫਾਫਾ ਜਸਟ ਖੋਲਿਆ ਹੀ ਆ ਅਤੇ ਇੰਨੀ ਸਮੈਲ ਆਣ ਦੇਈ ਆ ਬਾਕੀ ਅਜੇ ਦਾਲ ਤਾਂ ਮੈਂ ਖੋਲ ਕੇ ਨਹੀਂ ਦੇਖੀ ਉਹ ਵੀ ਮੈਂ ਖੋਲੂੰਗੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਬਹੁਤ ਬੋ ਮਾਰਦਾ ਪਿਆ ਵਾ ਮੇਰੇ ਤਾਂ ਘਰ ਪ੍ਰਾਹੁਣੇ ਆਏ ਮੈਨੂੰ ਇੰਨਾ ਮਤਲਬ ਕਿ ਬੇਇੱਜ਼ਤੀ ਮਹਿਸੂਸ ਹੋਈ ਨਾ ਆਪਣੀ ਹਾਂਜੀ ਮੈਂ ਔਡਰ ਵਾਲੇ ਭਾਈ ਨਾਲ ਵੀ ਗੱਲ ਕੀਤੀ ਸੀ ਸਵੀਗੀ ਵਾਲੇ ਉਹ ਕਹਿੰਦੇ ਸਾਡਾ ਤਾਂ ਕੰਮ ਹੈਗਾ ਸਿਰਫ਼ ਔਡਰ ਲੈ ਕੇ ਜਾਣਾ ਅਤੇ ਔਡਰ ਦੇ ਕੇ ਚਲ ਜਾਣਾ ਬਸ ਸਾਡਾ ਇਹਦੇ ਵਿੱਚ ਕੋਈ ਲਿਕ ਹਾਂਜੀ ਭਾਅ ਜੀ ਤੁਸੀਂ ਮੇਰਾ ਔਡਰ ਨੰਬਰ ਇਕ ਮਿੰਟ ਹੋਲਡ ਕਰੋ ਮੈਂ ਤੁਹਾਨੂੰ ਆਪਣਾ ਆਡਰ ਨੰਬਰ ਵੀ ਦੇ ਦਿੰਦੀ ਹਾਂ ਇਕ ਮਿੰਟ ਹੋਲਡ ਰੱਖਣਾ ਹੋਲਡ ਭਾਅ ਜੀ ਹਾਂਜੀ ਭਾਜੀ ਅਠਤਾਲੀ ਛਿਆਲੀ ਹਾਂਜੀ ਭਾਅ ਜੀ ਪਰ ਮੈਨੂੰ ਮੈਂ ਪਹਿਲੀ ਵਾਰ ਤੁਹਾਡੇ ਕੋਲ ਸਮਾਨ ਮੰਗਵਾਇਆ ਲੇਕਿਨ ਮੈਂ ਪਹਿਲੀ ਵਾਰ 'ਚ ਨਰਾਜ਼ ਹੋ ਗਈ ਹਾਂ ਮੈਨੂੰ ਨਹੀਂ ਤੁਹਾਡਾ ਇਹ ਨਹੀਂ ਸਹੀ ਨਹੀਂ ਲੱਗਾ ਜੋ ਵੀ ਆ ਮਤਲਬ ਇੰਨਾ ਸਮੈਲ ਆ ਰਹੀ ਖਾਣੇ ਚੋਂ ਮੈਨੂੰ ਤਾਂ ਬਹੁਤ ਗਲਤ ਲੱਗਾ ਮੇਰੇ ਘਰ ਪ੍ਰਾਹੁਣੇ ਬੈਠੇ ਹੋਏ ਨੇ ਹੁਣ ਮੈਂ ਦੱਸੋ ਤੁਸੀਂ ਕੀ ਕਰ ਸਕਦੀ ਹੈ ਅਸੀਂ ਝੂਠ ਥੋੜ੍ਹੀ ਨਾ ਭਾਅ ਜੀ ਤੁਹਾਡੇ ਨਾਲ ਕਹਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਮੇਰਾ ਆਰਡਰ ਹੁਣੇ ਹੀ ਵਾਪਸ ਜਾ ਤਾਂ ਲਿੱਤਾ ਜਾਵੇ ਅਤੇ ਜਾਂ ਮੇਰੇ ਪੈਸੇ ਰਿਫੰਡ ਹੋ ਜਾਣ ਮੈਨੂੰ ਮੇਰੇ ਪੈਸੇ ਵਾਪਸ ਕਰ ਦਿਓ ਹਾਂਜੀ ਭਾਅ ਜੀ ਹਾਂਜੀ ਓਕੇ ਧੰਨਵਾਦ ਭਾਅ ਜੀ